ਸਾਡੇ ਪਿੰਡ ਵਾਲੇ ਐਂਬੂਲੈਂਸ ਕਾਫੀ ਟਾਈਮ ਤੋਂ ਖਰਾਬ ਹੈ ਜਿਹਦੇ ਨਾਲ ਸਾਡੇ ਪਿੰਡ ਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਵਾਰ ਗਰਭਵਤੀ ਪਿੰਡ ਵਿੱਚ ਮਹਿਲਾਵਾਂ ਹੁੰਦੀਆਂ ਹਨ ਜਿਹਨਾਂ ਨੂੰ ਮੌਕੇ 'ਤੇ ਹਸਪਤਾਲ ਲਿਜਾਣਾ ਪੈਂਦਾ ਹੈ ਅਤੇ ਉਹ ਜਿਹੜੀ ਖਰਾਬ ਐਂਬੂਲੈਂਸ ਹੈ ਉਹਦੇ ਵਿੱਚ ਸਾਨੂੰ ਕੋਈ ਸਹੂਲਤ ਨਹੀਂ ਹੈ ਤਾਂ ਜੋ ਸਾਨੂੰ ਬਾਹਰੋਂ ਪ੍ਰਾਈਵੇਟ ਐਬੁਲੈਂਸ ਕਰਕੇ ਜਾਂ ਪ੍ਰਾਈਵੇਟ ਕੋਈ ਸਾਧਨ ਕਰਕੇ ਜਾਣਾ ਪੈਂਦਾ ਹੈ ਜਿਹਦੇ ਨਾਲ ਸਾਡੇ ਪੈਸੇ ਵੀ ਵੱਧ ਲੱਗਦੇ ਹਨ ਅਤੇ ਦੂਜਾ ਸਾਨੂੰ ਉਹ ਉਹਦੇ ਵਿੱਚ ਕੋਈ ਸਹੂਲਤ ਨਹੀਂ ਹੁੰਦੀ ਕਿਉਂਕਿ ਐਂਬੂਲੈਂਸ ਵਿੱਚ ਤਾਂ ਪੂਰੀ ਸਹੂਲਤ ਹੁੰਦੀ ਹੈ ਇਹ ਖਰਾਬ ਐਂਬੂਲੈਂਸ ਕਾਰਨ ਇਹ ਸਾਡੀ ਪਹਿਲੀ ਅਤੇ ਸਾਨੂੰ ਇਹ ਸਮੱਸਿਆ ਆਉਂਦੀ ਹੈ ਅਤੇ ਦੂਜੀ ਜਦੋਂ ਸਾਡਾ ਜਿਹੜਾ ਪਿੰਡ ਹੈ ਉਹ ਮੇਨ ਹਾਈਵੇ ਦੇ ਨਾਲ ਲੱਗਦਾ ਹੈ ਟਰੈਫਿਕ ਬਹੁਤ ਜ਼ਿਆਦਾ ਕਰਕੇ ਤੇਜ਼ ਹੋਣ ਕਰਕੇ ਉਹਦੇ 'ਤੇ ਕੋਈ ਨਾ ਕੋਈ ਡੇਲੀ ਜਾਂ ਇੱਕ ਦੋ ਦਿਨ ਛੱਡ ਕੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਅਤੇ ਸਾਡਾ ਪਿੰਡ ਨਾਲ ਲੱਗਦੇ ਹੋਣ ਕਰਕੇ ਸਾਡਾ ਜਿਹੜਾ ਹੈ ਨਾ ਮ ਅਤੇ ਹਿਊਮਨ ਨੇਚਰ ਕਰਕੇ ਸਾਡੀ ਉਹ ਬਣਦੀ ਹੈ ਭਾਵਨਾ ਬਣਦੀ ਕਿ ਤਾਂ ਜੋ ਅਸੀਂ ਉਹਦੀ ਜਾ ਕੇ ਮਦਦ ਕਰ ਸਕੀਏ ਅਤੇ ਅਸੀਂ ਉਹਨੂੰ ਐਬੂਲੈਂਸ ਵਿੱਚ ਪਾ ਕੇ ਹੋਸਪਿਟਲ ਛੱਡ ਦਈਏ ਪਰ ਜਦੋਂ ਅਸੀਂ ਉੱਥੇ ਜਾ ਕੇ ਦੇਖਦੇ ਹਾਂ ਕਿ ਮਰੀਜ਼ ਕਾਫੀ ਫੱਟੜ ਹੋਇਆ ਹੁੰਦਾ ਪਰ ਉਹਦੇ ਲਈ ਸਾਨੂੰ ਇੱਕ ਐਂਬੂਲੈਂਸ ਦੀ ਜ਼ਰੂਰਤ ਹੁੰਦੀ ਹੈ ਅਤੇ ਐਬੂਲੈਂਸ ਜਿਹੜੇ ਸਾਡੇ ਪਿੰਡ ਦੀ ਖਰਾਬ ਹੋਣ ਕਰਕੇ ਅਸੀਂ ਕਿਸੇ ਦੂਰ ਦਰੇਡੇ ਦੀ ਫੋਨ ਕਰਕੇ ਐਂਬੂਲੈਂਸ ਨੂੰ ਬੁਲਾਉਂਦੇ ਹਾਂ ਅਤੇ ਜਿੰਨੇ ਵਿੱਚ ਉਹ ਐਬੂਲੈਂਸ ਦੂਰ ਦਰੇਡੇ ਤੋਂ ਆਉਂਦੀ ਹੈ ਉਹ ਉਨੇ ਨੂੰ ਜਿਹੜਾ ਉਹ ਮਰੀਜ਼ ਆ ਹੋਰ ਵੀ ਜ਼ਿਆਦਾ ਸੀਰੀਅਸ ਹੋ ਜਾਂਦਾ ਹੈ ਅਤੇ ਉਹਦੇ ਨਾਲ ਜਿਹੜੀ ਉਹਦੀ ਜਾਨ ਨੂੰ ਹੋਰ ਵੀ ਖਤਰਾ ਵੱਧ ਜਾਂਦਾ ਹੈ ਕਿਉਂਕਿ ਮਰੀਜ਼ ਤਾਂ ਮਰੀਜ਼ ਲਈ ਇੱਕ ਮਿੰਟ ਮਿੰਟ ਵੀ ਬਹੁਤ ਜ਼ਰੂਰੀ ਹੈ ਤਾਂ ਉੱਥੇ ਉਹਦੀ ਜਾਨ ਇੱਕ ਮਿੰਟ ਦੇ ਵਿੱਚ ਵੀ ਬਚ ਸਕਦੀ ਹੈ ਨਹੀਂ ਕਈ ਵੇਲੇ ਮੌਕੇ 'ਤੇ ਉੱਥੇ ਜਾਨਾਂ ਵੀ ਮਰੀਜ਼ ਗਵਾ ਬੈਠਦੇ ਹਨ ਇਸ ਲਈ ਸਾਨੂੰ ਜਿਹੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਨਹੀਂ ਬਹੁਤ ਸਾਰੀਆਂ ਚੁਣੌਤੀਆਂ ਹਨ